ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਸੰਧੂ ਹਸਪਤਾਲ ਤੋਂ ਬੋਲਦੇ ਜੀ ਹਾਂਜੀ ਮੈਮ ਹਾਂਜੀ ਹਾਂਜੀ ਉਹਦਾ ਮੈਮ ਮੇਰੇ ਨਾ ਦੰਦ ਵਿੱਚ ਨਾ ਥੋੜ੍ਹੀ ਜੀ ਪ੍ਰੋਬਲਮ ਹੋ ਰਹੀ ਸੀਗੀ ਪਤਾ ਨਹੀਂ ਕਿਉਂ ਹੋ ਰਿਹਾ ਮਤਲਬ ਮੈਂ ਕੁਛ ਵੀ ਖਾ ਰਹੀ ਹਾਂ ਠੰਡਾ ਉਹਦੇ ਨਾਲ ਪ੍ਰੋਬਲਮ ਹੋ ਰਹੀ ਆ ਹਾਂਜੀ ਹਾਂਜੀ ਸ਼ਾਇਦ ਕੀੜਾ ਵੀ ਹੈਗਾ ਅਤੇ ਉਹਦੇ ਕਰਕੇ ਨਾ ਮਤਲਬ ਦਿੱਕਤ ਆ ਰਹੀ ਹੈ ਮਤਲਬ ਨਾ ਕੁਛ ਖਾਧਾ ਜਾ ਰਿਹਾ ਨਾ ਪੀਤਾ ਜਾ ਰਿਹਾ ਹਾਂ ਹਾਂਜੀ ਅੱਛਾ ਜੀ ਹਾਂਜੀ ਉਹ ਤਾਂ ਚੈੱਕ ਕਰ ਲਾਂਗੇ ਮਤਲਬ ਸ਼ਾਇਦ ਤੁਸੀਂ ਮੈਨੂੰ ਬਾਕੀ ਟਾਈਮ ਵਗੈਰਾ ਦੱਸ ਦਿਓ ਜੀ ਖਾ ਸਕਦੀ ਹੈ ਹੈਂ ਹਾਂਜੀ ਹਾਂਜੀ ਵੈਸੇ ਨਾ ਮੈਂ ਕੁਛ ਵੀ ਨਹੀਂ ਖਾਧਾ ਮਤਲਬ ਦੋ ਦਿਨ ਹੋ ਗਏ ਅਤੇ ਮੈਨੂੰ ਚੱਕਰ ਜਿਹੇ ਆ ਰਹੇ ਆ ਦੰਦ ਦੀ ਪ੍ਰੋਬਲਮ ਕਰਕੇ ਅਤੇ ਜੇ ਮੈਂ ਮਤਲਬ ਚਾਹ ਪੀ ਕੇ ਨਾ ਖਾਣਾ ਹੋਵੇ ਵੈਸੇ ਕੁਛ ਖਾਣਾ ਹੋਵੇ ਤਾਂ ਕੀ ਖਾ ਸਕਦੇ ਹਾਂਜੀ ਹਾਂਜੀ ਹਾਂਜੀ ਹਾਂਜੀ ਕਿਹੜਾ ਪੇਸਟ ਵਰਤਾ ਵੈਸੇ ਕੋਲਗੇਟ ਏ ਵਰਤਦੇ ਹਾਂਜੀ ਠੀਕ ਹੈ ਜੀ ਸੈਂਸੋਡਾਇਨ ਵਰਤ ਲਾਂਗੇ ਬਾਕੀ ਤਾਂ ਜਦੋਂ ਮੈਂ ਤੁਹਾਨੂੰ ਚੈੱਕ ਕਰਵਾਵਾਂਗੀ ਉਦੋਂ ਪਤਾ ਲੱਗ ਜਾਵੇਗਾ ਕੀ ਪ੍ਰੋਬਲਮ ਹੈਗੀ ਆ ਹਾਂਜੀ ਹਾਂਜੀ ਕੋਈ ਨਾ ਤੁਸੀਂ ਦੱਸ ਦਿਓ ਮਤਲਬ ਜੋ ਮੇਰੇ ਮਤਲਬ ਦੰਦਾਂ ਲਈ ਸਹੀ ਹੋਵੇ ਕਿਉਂਕਿ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਪਈ ਆ ਅਤੇ ਹੁਣ ਬੋਲਣ 'ਚ ਵੀ ਥੋੜ੍ਹੀ ਦਿੱਕਤ ਆ ਰਹੀ ਹੈ ਸਾਈਡ ਦਰਦ ਹੋ ਰਿਹਾ ਬਹੁਤ ਜ਼ਿਆਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਫਿਰ ਮੈਂ ਚੈੱਕ ਕਰਵਾ ਦੂ ਬਾਕੀ ਮੈਨੂੰ ਫੀਸ ਵਗੈਰਾ ਵੀ ਦੱਸ ਦਿਓ ਜੀ ਕਿੰਨੀ ਲੱਗੇਗੀ ਠੀਕ ਹੈ ਠੀਕ ਹੈ ਠੀਕ ਹੈ ਜੀ